ਮੇਰੇ ਲਈ ਸਭ ਤੋਂ ਵੱਡੀ ਪ੍ਰਾਪਤੀ ਇਹ ਹੈ ਕਿ ਮੈਂ ਨੈਸ਼ਨਲ ਗੱਤਕਾ ਐਸੋਸੀਏਸ਼ਨ ਰੋਪੜ ਵੱਲੋਂ ਕਰਵਾਏ ਗਏ ਗੱਤਕੇ ਮੁਕਾਬਲਾ ਵਿੱਚ ਪਹਿਲਾ ਸਥਾਨ ਹਾਸਲ ਕੀਤਾ ਹੈ ਮੈਂ ਇਸ ਮੁਕਾਬਲੇ ਵਿੱਚ ਸਿੰਗਲ ਫੋਟੀ ਇੰਡੀਵਿਜੂਅਲ ਵਿੱਚ ਪਹਿਲਾ ਸਥਾਨ ਹਾਸਲ ਕੀਤਾ ਅਤੇ ਫਰੀ ਫੋਟੀ ਟੀਮ ਵਿੱਚ ਦੂਜਾ ਸਥਾਨ ਹਾਸਲ ਕੀਤਾ ਅਤੇ ਇਸ ਇਸ ਲਈ ਮੈਂ ਹੁਣ ਅੱਗੇ ਰਾਜ ਪੱਧਰੀ ਖੇਡਾਂ ਵੀ ਖੇਡਣ ਜਾ ਰਿਹਾ ਹਾਂ ਇਸ ਗੱਲ ਉੱਤੇ ਮੈਨੂੰ ਅਤੇ ਮੇਰੇ ਪੂਰੇ ਪਰਿਵਾਰ ਨੂੰ ਬਹੁਤ ਮਾਣ ਹੈ ਕਿ ਮੈਂ ਆਪਣੇ ਜ਼ਿਲ੍ਹੇ ਨੂੰ ਰਾਜ ਪੱਧਰੀ ਖੇਡਾਂ ਵਿੱਚ ਦਰਸਾ ਰਿਹਾ ਹਾਂ ਮੈਂ ਇੱਕ ਕੋਲਜ ਦਾ ਵਿਦਿਆਰਥੀ ਹੋਣ ਕਰਕੇ ਉਹ ਪੜ੍ਹਾਈ ਕਾਰਨ ਇਸ ਖੇਡ ਨੂੰ ਜ਼ਿਆਦਾ ਸਮਾਂ ਨਹੀਂ ਦੇ ਪਾਉਂਦਾ ਸੀ ਪਰ ਮੈਂ ਇਸ ਵਿੱਚ ਬਹੁਤ ਜ਼ਿਆਦਾ ਮਿਹਨਤ ਕੀਤੀ ਅਤੇ ਇਸ ਪੱਧਰ ਉੱਤੇ ਪਹੁੰਚਿਆ ਹਾਂ ਜਿਸ ਟਾਇਮ ਇਹ ਮੁਕਾਬਲੇ ਹੋ ਰਹੇ ਸੀ ਉਸ ਸਮੇਂ ਮੇਰੇ ਪੇਪਰ ਵੀ ਚੱਲ ਰਹੇ ਸਨ ਪਰ ਪ ਪਰ ਮੈਂ ਦੋਹੇ ਚੀਜ਼ਾਂ ਨੂੰ ਕ ਨਾਲ ਕਰਦੇ ਹੋਏ ਦੋਨਾਂ ਵਿੱਚ ਵਧੀਆ ਬ ਵਧੀਆ ਕੀਤਾ ਅਤੇ ਇਸ ਖੇਡ ਵਿੱਚ ਪਹਿਲਾ ਸਥਾਨ ਹਾਸਲ ਕਰਕੇ ਆਪਣੇ ਅਤੇ ਆਪਣੇ ਪਰਿਵਾਰ ਨੂੰ ਮਾਣ ਦਵਾਇਆ